ਪੰਜਾਬ ਦੇ ਮੂਲ ਵਿੱਚ ਬਹੁਤ ਸਾਰੇ ਕਲਾ ਰੂਪ ਅਤੇ ਸ਼ਿਲਪਕਾਰੀ ਆਉਂਦੀਆਂ ਹਨ ਜਿਵੇਂ ਕਿ ਪੇਂਟਿੰਗਸ ਮੂਰਤੀ ਟੈਕਸਟਾਈਲ ਮਿੱਟੀ ਦੇ ਬਰਤਨ ਮਿੱਟੀ ਦੇ ਬਰਤਨ ਮਿੱਟੀ ਦੇ ਬਰਤਨ ਤੋਂ ਇੱਥੇ ਦੇ ਲੋਕ ਬਹੁਤ ਪ੍ਰਭਾਵਿਤ ਹਨ ਉਹ ਆਪਣੇ ਘਰ ਵਿੱਚ ਮੀ ਮਿੱਟੀ ਦੇ ਭਾਂਡੇ ਅਤੇ ਘੜੇ ਰੱਖਣਾ ਬਹੁਤ ਪਸੰਦ ਕਰਦੇ ਹਨ ਕਿਉਂਕਿ ਉਹਨਾਂ ਨੂੰ ਸਵੇਰੇ ਉੱਠ ਕੇ ਮਿੱਟੀ ਦੇ ਬਰਤਨ ਦਾ ਪਾਣੀ ਪੀਣਾ ਬਹੁਤ ਚੰਗਾ ਲੱਗਦਾ ਹੈ ਜੋ ਕਿ ਸਿਹਤ ਲਈ ਵੀ ਬਹੁਤ ਵਧੀਆ ਹੁੰਦਾ ਹੈ ਮਿੱਟੀ ਦੇ ਮੂਰਤੀਆਂ ਇੱਥੇ ਪੰਜਾਬ ਦੇ ਵਿੱਚ ਅੰਮ੍ਰਿਤਸਰ ਸ਼ਹਿਰ ਵਿੱਚ ਗੋਲਡਨ ਟੈਂਪਲ ਦੇ ਲਾਗੇ ਉਹਨਾਂ ਨੇ ਇੱਕ ਪੂਰਾ ਲੋਕਾਂ ਦੇ ਆਯੋਜਨ ਲਈ ਪ੍ਰਬੰਧ ਕੀਤਾ ਹੈ ਜਿਹਦੇ ਵਿੱਚ ਉਹਨਾਂ ਨੇ ਬਹੁਤ ਸਾਰੀਆਂ ਪੰਜਾਬੀ ਦੀਆਂ ਮੂਰਤੀਆਂ ਲਾਈਆਂ ਹਨ ਪੰਜਾਬੀ ਕਲਾਕਾਰਾਂ ਦੀਆਂ ਮੂਰਤੀਆਂ ਜੋ ਕਿ ਮਿੱਟੀ ਨਾਲ ਬਣੀਆਂ ਹਨ ਉਹਦੇ ਵਿੱਚ ਉਹ ਲੋਕ ਭੰਗੜਾ ਪਾ ਰਹੇ ਹਨ ਕੁੜੀਆਂ ਗਿੱਧਾ ਗਾ ਪਾ ਰਹੀਆਂ ਹਨ ਮਹਾਰਾਜਾ ਰਣਜੀਤ ਸਿੰਘ ਜੀ ਦੀ ਮੂਰਤੀ ਬਣਾਈ ਗਈ ਹੈ ਜੋ ਕਿ ਲੋਕਾਂ ਨੂੰ ਵੇਖ ਕੇ ਬਹੁਤ ਹੀ ਜ਼ਿਆਦਾ ਪ੍ਰਭਾਵਿਤ ਕਰਦੀ ਹੈ ਲੋਕ ਉਸ ਵਿੱਚ ਇੱਕ ਇਹੋ ਜਿਹੀ ਕਲਾ ਵੇਖਦੇ ਹਨ ਜੋ ਲੋਕਾਂ ਨੂੰ ਬਹੁਤ ਜ਼ਿਆਦਾ ਆਪਣੇ ਵੱਲ ਅਟਰੈਕਟ ਕਰਦੀ ਹੈ ਲੋਕ ਉੱਥੇ ਆਉਂਦੇ ਨੇ ਘੁੰਮਦੇ ਫਿਰਦੇ ਨੇ ਕਿਉਂ ਕਿਉਂਕਿ ਉਹਨਾਂ ਨੂੰ ਮਿੱਟੀ ਦਾ ਬਣਾਇਆ ਸਮਾਨ ਬਹੁਤ ਵਧੀਆ ਲੱਗਦਾ ਹੈ ਵੇਖਣ 'ਚ ਟੈਕਸਟਾਈਲ ਇੰਡਸਟਰੀਜ਼ ਇੱਥੇ ਬਹੁਤ ਹੈਗੀਆਂ ਨੇ ਪੰਜਾਬ ਦੇ ਵਿੱਚ ਅਤੇ ਲੋਕ ਮਿੱਟੀ ਦੇ ਭਾਂਡੇ ਜ਼ਿਆਦਾ ਆਪਣੇ ਘਰ ਵਿੱਚ ਇਸਤੇਮਾਲ ਕਰਨਾ ਚੰਗਾ ਸਮਝਦੇ ਹਨ ਮੂਰਤੀ ਪੰਜਾਬ ਵਿੱਚ